ਜਦੋਂ ਜਦੋਂ ਅਸੀਂ ਫੋਟੋਆਂ ਖਿੱਚਣ ਜਾਂਦੇ ਹਾਂ ਤਾਂ ਸੈਮਸੰਗ ਕੈਮਰੇ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ ਕਿਉਂਕਿ ਕੈਮਰੇ ਵਿੱਚ ਫੋਟੋ ਬਹੁਤ ਹੀ ਵਧੀਆ ਆਉਂਦੀਆਂ ਹਨ ਮੈਨੂੰ ਫੋਟੋਆਂ ਖਿੱਚਣ ਦਾ ਬਹੁਤ ਹੀ ਜ਼ਿਆਦਾ ਚਾਅ ਹੈ ਮੈਂ ਕਿਤੇ ਵੀ ਜਾਂਦਾ ਹਾਂ ਕੈਮਰੇ ਨੂੰ ਆਪਣੇ ਨਾਲ ਹੀ ਰੱਖਦਾ ਹਾਂ ਵੀਡੀਓ ਵੁਡੀਓ ਸ਼ੂਟ ਅਤੇ ਫੋਟੋ ਵੀ ਖਿੱਚਦਾ ਹਾਂ ਇਸ ਵਿੱਚ ਫੋਟੋਆਂ ਬਹੁਤ ਹੀ ਜ਼ਿਆਦਾ ਸਾਫ਼ ਆਉਂਦੀਆਂ ਹਨ ਆਪਾਂ ਅਸੀਂ ਕਿਸੇ ਹੋਰ ਦੀ ਵੀ ਵੀਡੀਓ ਬਣਾਉਂਦੇ ਹਾਂ ਅਤੇ ਆਪਦੀ ਵੀ ਬਣਾਉਂਦੇ ਹਾਂ ਵਲੋਗ ਵੀ ਬਣਾਉਂਦੇ ਹਾਂ ਇਸ ਵਿੱਚ ਸਾਨੂੰ ਬਹੁਤ ਹੀ ਮਜ਼ਾ ਆਉਂਦਾ ਹੈ ਕੈਮਰੇ ਦੀ ਵਰਤੋਂ ਵਿਆਹ ਸ਼ਾਦੀ ਵਿੱਚ ਵੀ ਬਹੁਤ ਹੀ ਜ਼ਿਆਦਾ ਕੀਤੀ ਜਾਂਦੀ ਹੈ ਅਸੀਂ ਕਿਤੇ ਬਾਹਰ ਵੀ ਜਾਂਦੇ ਹਾਂ ਓਥੇ ਵੀ ਵਰਤੋਂ ਬਹੁਤ ਹੀ ਜ਼ਿਆਦਾ ਹੁੰਦੀ ਹੈ ਸੈਮਸੰਗ ਕੈਮਰੇ ਦੀ ਵਰਤੋਂ ਹੀ ਜ਼ਿਆਦਾ ਤੋਂ ਜ਼ਿਆਦਾ ਹੁੰਦੀ ਹੈ ਇਹ ਕੈਮਰੇ ਵਿੱਚ ਫੋਟੋਆਂ ਅਤੇ ਵੀਡੀਓ ਬਹੁਤ ਹੀ ਸਾਫ਼ ਆਉਂਦੀਆਂ ਹਨ ਇਸ